ਪੰਜਾਬੀ ਭਾਸ਼ਾ ਸਾਡੀ ਵਿਲੱਖਣ ਭਾਸ਼ਾ ਹੈ ਮਾਤ ਭਾਸ਼ਾ ਸਾਡੀ ਸਾਡੀ ਪਹਿਲੀ ਬੋਲੀ ਮਾਂ ਭਾਸ਼ਾ ਹੈ ਜਿਸ ਵਿੱਚ ਜਿਸ ਨਾਲ ਅਸੀਂ ਅਸੀਂ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਨੂੰ ਵਰਤੋਂ ਵਿੱਚ ਲੈ ਕੇ ਆਉਂਦੇ ਹਾਂ ਰੋਜ਼ ਅਸੀਂ ਇਸ ਦੀਆਂ ਨਵੀਆਂ ਨਵੀਆਂ ਨਵੇਂ ਨਵੇਂ ਵਿਚਾਰ ਪ੍ਰਗਟਾਉਂਦੇ ਹਾਂ ਆਪਣੇ ਸੱਭਿਆਚਾਰ ਸੱਭਿਆਚਾਰ ਲਈ ਸਾਨੂੰ ਬਹੁਤ ਸਾਰੀਆਂ ਬਹੁਤ ਸਾਰੀਆਂ ਜਾਣਕਾਰੀਆਂ ਮਿਲਦੀਆਂ ਹਨ ਸੱਭਿਆਚਾਰ ਸਾਡੇ ਪੰਜਾਬੀ ਭਾਸ਼ਾ ਦਾ ਇੱਕ ਵਿਲੱਖਣ ਸਰੋਤ ਹੈ ਇਹ ਸਾ ਇਹ ਸਾਨੂੰ ਆਪਣੀ ਮਾਂ ਕੋਲੋਂ ਮਿਲਦੀ ਹੈ ਮਾਂ ਬੋਲੀ ਬਚਪਨ ਤੋਂ ਹੀ ਅਸੀਂ ਪੰਜਾ ਬ ਪੰਜਾਬੀ ਮਾਂ ਬੋਲੀ ਬੋਲਦੇ ਹਾਂ ਪੰਜਾਬੀ ਮਾਂ ਬੋਲੀ ਸਾਡੇ ਸੱਭਿਆਚਾਰ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਜਿਵੇਂ ਕਿ ਅਸੀਂ ਪਿਛਲੇ ਵਿਰਸੇ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਪੰਜਾਬੀ ਮਾਂ ਬੋਲੀ ਨਾਲ ਦੂਜੇ ਦੇਸ਼ਾਂ ਵਿੱਚ ਜਾ ਕੇ ਵੀ ਸਾਨੂੰ ਇੱਕ ਵਿਲੱਖਣ ਪਹਿਚਾਣ ਮਿਲਦੀ ਹੈ ਪੰਜਾਬੀ ਭਾਸ਼ਾ ਨਾਲ ਪੰਜਾਬੀ ਭਾਸ਼ਾ ਭਾਸ਼ਾ ਸਾਡੇ ਨਿੱਤ ਵਰਤੋਂ ਦੇ ਵਿੱਚ ਆਉਣ ਵਾਲੀ ਇੱਕ ਭਾਸ਼ਾ ਹੈ ਜਿਸ ਨਾਲ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਦੇਖਦੇ ਹਾਂ ਸੁਣਦੇ ਹਾਂ ਪੜ੍ਹਦੇ ਹਾਂ ਪੰਜਾਬੀ ਭਾਸ਼ਾ ਸਾਡੇ ਵ ਸੱਭਿਆਚਾਰ ਅਤੇ ਪਹਿਚਾਣ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਜਿਵੇਂ ਕਿ ਸੱਭਿਆਚਾਰ ਪੁਰਾਣੇ ਵਿਰਸੇ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ ਬਹੁਤ ਸਾਰੀਆਂ ਸਾਨੂੰ ਰੋਲ ਮਾਡਲ ਪ੍ਰਾਪਤ ਹੁੰਦੇ ਹਨ ਪੰਜਾਬੀ ਭਾਸ਼ਾ ਨਾਲ ਗੁ ਗੁਰਮੁਖੀ ਲਿਪੀ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ ਗੁਰਬਾਣੀ ਅਸੀਂ ਪੰਜਾਬੀ ਭਾਸ਼ਾ ਨਾਲ ਹੀ ਪੜ੍ਹ ਸਕਦੇ ਹਾਂ ਜੋ ਜ ਜੇਕਰ ਸਾਨੂੰ ਪੰਜਾਬੀ ਭਾਸ਼ਾ ਆਉਂਦੀ ਹੋਊਗੀ ਤਾਂ ਅਸੀਂ ਗੁਰਬਾਣੀ ਦੀ ਤੁਕਾਂ ਉਹਨਾਂ ਗੁਰਬਾਣੀ ਦੇ ਪਾਠ ਨੂੰ ਪੂਰਾ ਪੜ੍ਹ ਸਕਦੇ ਹਾਂ ਬਹੁਤ ਸਾਰੀਆਂ ਭਾ ਪੰਜਾਬੀ ਭਾਸ਼ਾ ਨੇ ਸਾਡੇ ਸੱਭਿਆਚਾਰ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਅਸੀਂ ਅੱਗੇ ਤੋਂ ਅੱਗੇ ਪੰਜਾਬੀ ਭਾਸ਼ਾ ਨ ਨਾਲ ਹੀ ਆਪਣੇ ਸੱਭਿਆਚਾਰ ਨੂੰ ਅੱਗੇ ਵਢਾ ਵਧਾਉਂਦੇ ਹਾਂ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਹਨ ਜੋ ਸੱਭਿਆਚਾਰ ਪੰਜਾਬੀ ਭਾਸ਼ਾ ਨਾਲ ਸੱਭਿਆਚਾਰ ਨੂੰ ਅੱਗੇ ਲੈ ਕੇ ਆਉਂਦੇ ਹਨ